ਚਰਚਾ ਕਰ ਸਕਦੇ ਹਾਂ ਜੀ ਸਾਨੂੰ ਸਿੰਗਿੰਗ ਇੱਕ ਪਰਮਾਤਮਾ ਵੱਲੋਂ ਬਖਸ਼ੀ ਹੋਈ ਇੱਕ ਅਲਾਮਤ ਹੈ ਤਾਂ ਹੀ ਬੰਦਾ ਗਾ ਸਕਦਾ ਹੈ ਇਸ ਕਰਕੇ ਮੇਰਾ ਜੋ ਗਾਉਣ ਦਾ ਇੱਛਾ ਬੜੀ ਬਚਪਨ ਤੋਂ ਹੀ ਸੀ ਕਿਉਂਕਿ ਸਾਡਾ ਪਰਿਵਾਰਕ ਪਿਛੋਕੜ ਵੀ ਗਾਉਂਦਾ ਸੀ ਪਰ ਇੰਨੇ ਅਸੀਂ ਕੋਈ ਮਸ਼ਹੂਰ ਤਾਂ ਨਹੀਂ ਸੀ ਹੈ ਪਰ ਸ਼ੌਂਕ ਸੀ ਇੱਕ ਸ਼ੌਂਕ ਸੀ ਗਾਉਣ ਦਾ ਕਿਉਂਕਿ ਪਰਿਵਾਰਕ ਪਿਛੋਕੜ ਕਰਕੇ ਗਾਉਣ ਦਾ ਬਹੁਤ ਸ਼ੌਂਕ ਸੀ ਤਾਂ ਇਸ ਕਰਕੇ ਮੈਨੂੰ ਗਾਉਣ ਦਾ ਜ਼ਿਆਦਾ ਜ਼ਿਆਦਾ ਸਿੱਖਿਆ ਹੋਣਾ ਬਹੁਤ ਜ਼ਰੂਰੀ ਆ ਗਾਉਣ ਲਈ ਵੈਸੇ ਤਾਂ ਇਹ ਪਰਮਾਤਮਾ ਵਲੋਂ ਬਖਸ਼ੀ ਹੋਈ ਇੱਕ ਅਲਾਮਤ ਹੈ ਅਤੇ ਗਾਉਣ ਦਾ ਸ਼ੌਂਕ ਕਾਫੀ ਹੈ ਰੱਬ ਪਰਮਾਤਮਾ ਦੀ ਸ਼ਬਦ ਗਾਣੇ ਕੋਈ ਭਜਨ ਗਾਣੇ ਇੱਦਾਂ ਦੇ ਸ਼ੌਂਕ ਮੈਨੂੰ ਬਹੁਤ ਹੈ ਅਤੇ ਗਾਉਣ ਦੀ ਇੱਛਾ ਮੇਰੇ ਬਚਪਨ ਤੋਂ ਹੀ ਸੀ ਹੁਣ ਵੀ ਗਾਨਾ ਵਾਂ

ਬ ਹਰ ਕਿਸਮ ਦਾ ਗਾ ਲਈਦਾ ਪੰਜਾਬੀ ਵੀ ਗਾ ਲਈਦਾ ਹਿੰਦੀ ਵੀ ਗਾ ਲਈਦਾ ਬੜੀ ਦਿਲ ਤਾਂ ਬਹੁਤ ਕਰਦਾ ਵੀ ਕਾਫੀ ਉੱਪਰ ਤੱਕ ਜਾਈਏ ਪਰ ਨਾਲ ਬਿਜਨਸ ਕਰਨ ਕਰਕੇ ਪੂਰੀ ਇੱਛਾਵਾਂ ਤਾਂ ਨਹੀਂ ਕਰ ਸਕਦੇ ਅਸੀਂ ਪਰ ਜਿੰਨਾ ਕੁ ਸ਼ੌਂਕ ਹੈ ਓਨਾ ਕੁ ਤਾਂ ਗਾ ਹੀ ਲੈਂਦੇ ਹਾਂ ਆਪਣਾ ਘਰ ਬੈਠ ਕੇ ਗਾ ਲਈਦਾ ਵਾ ਕੋਈ ਮੈਂ ਅੱਜ ਤੱਕ ਕੋਈ ਵੱਡੀ ਸਟੇਜ ਤਾਂ ਲਾਈ ਨਹੀਂ ਜਿਹਦੇ ਬਾਰੇ ਮੈਨੂੰ ਇੰਨੀ ਨੌਲੇਜ ਹੋਵੇ ਇਸ ਕਰਕੇ ਸਿੰਗਰ 'ਚ ਇੱਕ ਵਧੀਆ ਟ੍ਰੇਨਡ ਸਿੰਗਰ ਹੋਣਾ ਬਹੁਤ ਜ਼ਰੂਰੀ ਆ ਸਿੰਗਿੰਗ ਵਾਸਤੇ ਅੱਛਾ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ ਸਿੰਗਿੰਗ ਵਾਸਤੇ ਅਤੇ ਬਸ ਇੰਨਾਂ ਹੀ ਆ ਇੱਛਾ ਤਾਂ ਮੇਰੀ ਬਹੁਤ ਆ ਕੋਈ ਚੰਗੇ ਉੱਚ ਕੋਟੀ ਦੇ ਸਿੰਗਰਾਂ ਤੋਂ ਸਿੱਖੀਏ